ਦੇਖੋ ਜੀ ਮੈਂ ਜੋਬ ਕਰਦਾ ਵਾ ਅਤੇ ਜੋਬ ਕਰਨ ਤੋਂ ਬਾਅਦ ਤਿੰਨ ਘੰਟੇ ਮੈਂ ਸ਼ਾਮ ਦੇ ਆਪਣੇ ਫਾਰਮ ਵਿੱਚ ਬਿਤਾਉਂਦਾ ਗਾ ਅਤੇ ਖੇਤੀ ਦਾ ਅਤੇ ਸਿਹਤ ਦਾ ਕਾਫੀ ਵੱਡਾ ਤਾਲਮੇਲ ਆ ਜੋ ਹੈਗਾ ਅਤੇ ਖੇਤੀ ਖੇਤੀ ਨੂੰ ਆਪਾਂ ਸਿਹਤਮੰਦ ਬਣਾਉਣ ਲਈ ਆਪਣੇ ਜ਼ਮੀਨ ਦੇ ਵਿੱਚ ਰੇਹ ਸਪਰੇਅ ਦਾ ਘੱਟ ਯੂਜ ਕਰਨਾ ਚਾਹੀਦਾ ਅਤੇ ਜੋ ਆਪਾਂ ਨਿਰਾ ਗਾਵਾਂ ਨੂੰ ਪਾਉਂਦੇ ਹਾਂ ਉਸ ਦੇ ਰਾਹੀਂ ਉਹਨਾਂ ਪਸ਼ੂਆਂ ਦੇ ਅੰਦਰ ਜੋ ਕੀਟਨਾਸ਼ਕ ਦਵਾਈਆਂ ਜਾਂਦੀਆਂ ਤਾਂ ਉਹਦੇ ਨਾਲ ਸਿਹਤ ਨਾਲ ਇੱਕ ਖਿਲਵਾੜ ਹੁੰਦਾ ਗਾ ਅਤੇ ਜੋ ਆਪਾਂ ਕੀੜੇ ਮਾਰ ਦਵਾਈਆਂ ਸਰਪੇਹਾਂ ਜੋ ਫਸਲਾਂ ਦੇ ਉੱਤੇ ਪਾਉਂਦੇ ਹਾਂ ਉਹ ਵੀ ਆਪਣੇ ਖਾਣੇ ਦੇ ਰਾਹੀਂ ਆਪਣੇ ਫਸਲਾਂ ਦੇ ਰਾਹੀਂ ਆਪਣੀਆਂ ਸਬਜ਼ੀਆਂ ਦੇ ਰਾਹੀਂ ਇਹ ਅੰਦਰ ਜਾਂਦੀਆਂ ਅਤੇ ਆਪਣੀ ਸਿਹਤ ਨੂੰ ਇੱਕ ਮਾੜਾ ਪ੍ਰਭਾਵ ਦਿੰਦੀਆਂ ਅਤੇ ਇਸ ਨੂੰ ਵਧੀਆ ਕਰਨ ਵਾਸਤੇ ਓਰਗੈਨਿਕ ਖੇਤੀ ਹੁੰਦੀ ਹੈ ਇੱਕ ਬਿਨਾਂ ਰੇਹ ਸਪਰੇ ਤੋਂ ਉਹ ਕਰਨੀ ਚਾਹੀਦੀ ਹੈ ਉਹਦੇ ਨਾਲ ਕਾਫੀ ਫਾਇਦਾ ਹੋ ਸਕਦਾ ਗਾ ਆਪਣੀ ਸਿਹਤ ਨੂੰ